ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਲਈ ਸਾਨੂੰ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ ਸਾਨੂੰ ਆਪਣੇ ਸੱਭਿਆਚਾਰ ਨੂੰ ਸੰਭਾਲਣ ਦੇ ਲਈ ਪੁਰਾਣੇ ਟਾਈਮ ਦੇ ਵਿੱਚ ਜੋ ਰੀਤ ਰਿਵਾਜ ਸਨ ਉਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਨਾ ਪਵੇਗਾ ਜੇ ਕੋਈ ਵੀ ਘਰ ਦੇ ਵਿੱਚ ਫੰਕਸ਼ਨ ਹੁੰਦਾ ਹੈ ਤਾਂ ਉਸ ਦੇ ਵਿੱਚ ਉਹਨਾਂ ਸਾਰੀਆਂ ਰੀਤੀਆਂ ਨੂੰ ਦੁਬਾਰਾ ਤੋਂ ਸੰਭਾਲਣ ਦੀ ਲੋੜ ਹੈ ਤਾਂ ਕਿ ਘਰ ਦੇ ਸਾਰੇ ਮੈਂਬਰ ਇੱਕ ਦੂਜੇ ਨਾਲ਼ ਸਾਂਝ ਪਾਉਣ ਅਤੇ ਦੂਰੀ ਘੱਟ ਹੋਵੇ ਸੱਭਿਆਚਾਰਕ ਪਹਿਰਾਵੇ ਅਤੇ ਖਾਣ ਪੀਣ ਨੂੰ ਵੀ ਸੰਭਾਲ ਜ਼ਰੂਰੀ ਹੈ ਰੁਟੀਨ ਦੇ ਵਿੱਚ ਪੁਰਾਣੇ ਵਕਤ ਦਾ ਜੋ ਪਹਿਨਣ ਖਾਣਾ ਸੀ ਉਸ ਹਿਸਾਬ ਨਾਲ਼ ਹੀ ਚੱਲਣਾ ਚਾਹੀਦਾ ਹੈ ਤਾਂ ਕਿ ਇਹ ਸਾਨੂੰ ਸਿਹਤ ਪੱਖੋਂ ਅਤੇ ਹੋਰ ਗੱਲਾਂ ਕਾਰਨ ਵੀ ਕਾਫ਼ੀ ਲਾਭਦਾਇਕ ਹੋਏਗਾ